ਹੈਲੋ ਬਸ ਠੀਕ ਹੈ ਆਪ ਕੌਣ ਬੋਲਦੇ ਸੀ ਫਰੈਂਡ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਹਾਂਜੀ ਹੋਰ ਪਲਊਸ਼ਨ ਤਾਂ ਹੈਗਾ ਆ ਪਤਾ ਕੀ ਗੱਲ ਟ੍ਰੈਫਿਕ ਬਹੁਤ ਜ਼ਿਆਦਾ ਹੈ ਪਤਾ ਕੀ ਆ ਬੱਚਿਆਂ ਨੂੰ ਸਾਹ ਚੜ੍ਹਨ ਲੱਗ ਪਿਆ ਉਹ ਹੀ ਬੁਰਾ ਹਾਲ ਹੁੰਦਾ ਵਾ ਅਤੇ ਬਾਕੀ ਵੀ ਵੀ ਬੁਰਾ ਹੀ ਹਾਲ ਆ ਇਹ ਗਾਵਾਂ ਮੱਝਾਂ ਘੁੰਮਦੀਆਂ ਰਹਿੰਦੀਆਂ ਘੁੰਮਦੀਆਂ ਵਾ ਜਾਂ ਕੁਛ ਆ ਪਰ ਇੱਦਾਂ ਹੀ ਹਾਲ ਹੈ ਨਹੀਂ ਟੈਮ ਟੈਮ 'ਤੇ ਮਿਲਦੀਆਂ ਪੂਰੇ ਟੈਮ 'ਤੇ ਮਿਲ ਜਾਂਦੀਆਂ ਨੇ ਬੱਸਾਂ ਹਾਂ ਹੋਰ ਸਭ ਠੀਕ ਹੈ ਸਾਰੀਆਂ ਸਹੂਲ ਹਾਂਜੀ ਸਹੂਲਤਾਂ ਸਾਰੀਆਂ ਸਭ ਹੈਗੀਆਂ ਹਾਂਜੀ ਹਾਂਜੀ ਠੀਕ ਹੈ ਹਾਂ ਹੋਰ ਸਭ ਠੀਕ ਹੈ ਹਾਂ ਚੱਲੋ ਠੀਕ ਹੈ ਜੀ